ਸਕੂਲਾਂ ਵਿੱਚ ਅਧਿਆਪਕਾਂ ਨੂੰ ਪੜ੍ਹਾਉਣ ਲਈ ਜਿੱਥੇ ਬਲੈਕਬੋਰਡ ਚੋਕ ਆਦਿ ਦੀ ਲੋੜ ਹੈ ਉੱਥੇ ਹੀ ਅੱਜ ਦੇ ਵਿਗਿਆਨਿਕ ਯੁੱਗ ਦੇ ਵਿੱਚ ਇਲੈਕਟਰੋਨਿਕ ਉਪਕਰਨਾਂ ਦੀ ਵੀ ਲੋੜ ਹੈ ਜਿਵੇਂ ਕਿ ਐਲ ਸੀ ਡੀ ਪ੍ਰੋਜੈਕਟਰ ਕੰਪਿਊਟਰ ਜਿਸ ਤੋਂ ਨਵੀਆਂ ਨਵੀਆਂ ਟੈਕਨੋਲਜੀ ਅਤੇ ਹੋਰ ਪੜ੍ਹਾਈ ਬਾਰੇ ਨਵੇਂ ਨਵੇਂ ਖੇਤਰ ਵਿੱਚ ਹੋ ਰਹੀਆਂ ਖੋਜਾਂ ਬਾਰੇ ਬੱਚਿਆਂ ਨੂੰ ਦੱਸਿਆ ਜਾ ਸਕੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਵੀ ਵੱਡੇ ਵਿਗਿਆਨੀ ਬਣਨ 'ਤੇ ਵੱਡੇ ਹੋਰ ਕੰਮ ਕਰਕੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ ਸਕੂਲਾਂ ਵਿੱਚ ਕਾਫੀ ਥਾਵਾਂ 'ਤੇ ਅਜਿਹੀਆਂ ਉਪਕਰਨ ਅਤੇ ਹੋਰ ਚੀਜ਼ਾਂ ਦੀ ਲੋੜ ਹੈ ਸੋ ਇਹਨਾਂ ਲਈ ਵੀ ਸਾਨੂੰ ਸਾਰਿਆਂ ਨੂੰ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ